ਮੈਂ ਘੁੰਮਣ ਫਿਰਨ ਦਾ ਬਹੁਤ ਸ਼ੌਕੀਨ ਹਾਂ ਘੁੰਮਣ ਫਿਰਨ ਨੂੰ ਜੇ ਕਿਤੇ ਮੈਨੂੰ ਮੌਕਾ ਮਿਲਿਆ ਬਾਹਰ ਜਾਣ ਦਾ ਤਾਂ ਮੈਂ ਕਨੇਡਾ ਨੂੰ ਪਹਿਲ ਦੇਵਾਂਗਾ ਦੁਨੀਆਂ ਦੇ ਵਿੱਚ ਉਹਦੀਆਂ ਕੁਝ ਖਾਸ ਵਜ੍ਹਾ ਹਨ ਉਹ ਵਜ੍ਹਾ ਇਹ ਕਰਕੇ ਵੀ ਮੇਰੇ ਕਾਫ਼ੀ ਰਿਸ਼ਤੇਦਾਰ ਜਿਹੜੇ ਆ ਮਾਮੇ ਦੇ ਮੁੰਡੇ ਲੜਕੀਆਂ ਵਗੈਰਾ ਉੱਥੇ ਰਹਿੰਦੇ ਆ ਉਹਨਾਂ ਨੇ ਸਰਵਾਈਵ ਕੀਤਾ ਵਾ ਉੱਥੇ ਰਹਿੰਦੇ ਆ ਉੱਥੇ ਸਟੱਡੀ ਬੇਸ 'ਤੇ ਗਏ ਨੇ ਉੱਥੇ ਮੈਂ ਜਾਣਾ ਚਾਹਵਾਂਗਾ ਕਿਉਂਕਿ ਉਹ ਮੈਨੂੰ ਉੱਥੇ ਘੁੰਮਾ ਫਿਰਾ ਸਕਦੇ ਆ ਉੱਥੇ ਜਾ ਕੇ ਮੈਨੂੰ ਮੈਂ ਨਿਆਗਰਾ ਫਾਲ ਗਲੇਸ਼ੀਅਰ ਮੈਰੋਨ ਲੇਕ ਲੇਕ ਓਂਟਾਰੀਓ ਦੇਖਣਾ ਚਾਹੁੰਦਾ ਹਾਂ ਇਹਨਾਂ ਸਾਰਿਆਂ ਦੇ ਵਿੱਚ ਮੈਨੂੰ ਨਿਆਗਰਾ ਫਾਲ ਆ ਉਹ ਦੇਖਣ ਦੀ ਬਹੁਤ ਚਾਹਤ ਆ ਉਸ ਤੋਂ ਇਲਾਵਾ ਮੈਂ ਇੱਕ ਗੁਰਸਿੱਖ ਹੋਣ ਦੇ ਨਾਤੇ ਉੱਥੇ ਜਿਹੜੇ ਇਤਿਹਾਸਿਕ ਗੁਰਦੁਆਰਾ ਤਾਂ ਨਹੀਂ ਹੈ ਪਰ ਜਿਹੜੇ ਸਾਡੇ ਸਿੱਖਾਂ ਨੇ ਜਾ ਕੇ ਉੱਥੇ ਗੁਰਦੁਆਰੇ ਵਸਾਏ ਆ ਉਹ ਦੇਖਣੇ ਚਾਹਵਾਂਗਾ ਜਿਸ ਤਰ੍ਹਾਂ ਜੋਤ ਪ੍ਰਕਾਸ਼ ਸਾਹਿਬ ਹੈ ਬਰੈਂਪਟਨ ਦੇ ਵਿੱਚ ਗੁਰਸਿੱਖ ਗੁਰਦੁਆਰਾ ਇਹ ਗੁਰਦੁਆਰਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਇਹ ਦੇਖਣ ਨੂੰ ਮੈਂ ਪਹਿਲ ਦੇਵਾਂਗਾ